ਲੋਕ ਵਿਆਹ ਵਿੱਚ ਲਾੜੀ ਨੂੰ ਬਹੁਤ ਸਾਰੇ ਤੋਹਫੇ ਦਿੱਤੇ ਜਾਂਦੇ ਹਨ ਜਿਵੇਂ ਕਿ ਦਾਜ ਵੀ ਦਾਜ ਵੀ ਦਿੱਤਾ ਜਾਂਦਾ ਹੈ ਦਾਜ ਵਿੱਚ ਜਿਵੇਂ ਫਰਨੀਚਰ ਜਿਵੇਂ ਸੋਫਾ ਸੈੱਟ ਅਤੇ ਡਰੈਸਿੰਗ ਟੇਬਲ ਵੀ ਦਿੱਤਾ ਜਾਂਦਾ ਹੈ ਅਤੇ ਅੱਜ ਕੱਲ੍ਹ ਤਾਂ ਲੋਕ ਐ ਹੈਸੀਅਤ ਦੀ ਹੈਸੀਅਤ ਦੇਖ ਕੇ ਦਿੰਦੇ ਹਨ ਜਿਵੇਂ ਕਿ ਮੋਟਰਸਾਈਕਲ ਦੇ ਦਿੰਦੇ ਆ ਗੱਡੀ ਵਗੈਰਾ ਆਦਿ ਅਤੇ ਲਾੜੀ ਦੇ ਲਾੜੀ ਨੂੰ ਕੁੜੀਆਂ ਦੇ ਤੌਰ 'ਤੇ ਜਿਵੇਂ ਕਿ ਫਰੈਂਡਸ ਦੇ ਤੌਰ 'ਤੇ ਉਹਨਾਂ ਨੂੰ ਤੋਹਫੇ ਦਿੱਤੇ ਜਾਂਦੇ ਹਨ ਜਿਵੇਂ ਕਿ ਲੋਕ ਸੀਨਰੀ ਗਲਾਸ ਸੈੱਟ